ਵੀਹ ਅਗਸਤ ਦੋ ਹਜ਼ਾਰ ਨੌ ਬਾਰ੍ਹਾਂ ਜੁਲਾਈ ਦੋ ਹਜ਼ਾਰ ਇੱਕ ਪੰਦਰਾਂ ਫਰਵਰੀ ਦੋ ਹਜ਼ਾਰ ਪੰਜ ਉੱਨੀ ਜਨਵਰੀ ਦੋ ਹਜ਼ਾਰ ਗਿਆਰ੍ਹਾਂ ਸੱਤ ਨਵੰਬਰ ਉੱਨੀ ਸੌ ਅੱਸੀ